ਜਦੋਂ ਅਸੀਂ ਸਕੂਲ ਵਿੱਚ ਪੜ੍ਹਦੇ ਸੀ ਤਾਂ ਉੱਥੇ ਲਾਈਬ੍ਰੇਰੀ ਵਿੱਚ ਜਾ ਕੇ ਅਸੀਂ ਬਹੁਤ ਸਾਰੀਆਂ ਬੁੱਕਾਂ ਪੜ੍ਹਦੇ ਸਾਂ ਮੈਨੂੰ ਅਜੇ ਵੀ ਥੋੜ੍ਹਾ ਥੋੜ੍ਹਾ ਯਾਦ ਆ ਕਿ ਉੱਥੇ ਇੱਕ ਬੁੱਕ ਹੁੰਦੀ ਸੀ ਚੱਲ ਗਿਆ ਤਾਂ ਤੀਰ ਨਹੀਂ ਤਾਂ ਤੁੱਕਾ ਜਿਸ ਵਿੱਚ ਬਹੁਤ ਹੀ ਜ਼ਿਆਦਾ ਹੱਸਣ ਵਾਲੀ ਗੱਲਾਂ ਹੁੰਦੀਆਂ ਸਨ ਜਿਸ ਵਿੱਚ ਉਹ ਬਹੁਤ ਸਾਰੇ ਕੰਮ ਕਰਦਾ ਸੀ ਕਈ ਵਾਰ ਤਾਂ ਉਹ ਸਿੱਧੇ ਹੋ ਜਾਂਦੇ ਸੀ ਕਈ ਵਾਰ ਤਾਂ ਉਹ ਚੱਲਦੇ ਹੀ ਨਹੀਂ ਸਨ ਕਈ ਵਾਰ ਉਸ ਦਾ ਕੰਮ ਹੋ ਜਾਂਦਾ ਸੀ ਅਤੇ ਕਈ ਵਾਰ ਨਹੀਂ ਅਸੀਂ ਅਕਸਰ ਬਹੁਤ ਸਾਰੀਆਂ ਅਖਬਾਰਾਂ ਵਿੱਚ ਪੜ੍ਹਦੇ ਹਾਂ ਜਿਵੇਂ ਕਿ ਚੁਟਕਲੇ ਦਿੱਤੇ ਹੁੰਦੇ ਹਨ ਬਹੁਤ ਸਾਰੀਆਂ ਗੱਲਾਂ ਜਿਵੇਂ ਜਿਸ ਵਿੱਚ ਬਹੁਤ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ ਜਿਸ ਵਿੱਚ ਚੁਟਕਲੇ ਹੁੰਦੇ ਹਨ ਹਸਗੁੱਲੇ ਹੁੰਦੇ ਹਨ ਅਤੇ ਆਪਾਂ ਬਹੁਤ ਸਾਰੇ ਮਸਤੀ ਮਜ਼ਾਕ ਵਾਲੇ ਚੁਟਕਲੇ ਉਸ ਵਿੱਚੋਂ ਪੜ੍ਹ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਵਿੱਚ ਵੀ ਮਜ਼ਾਕ ਮਸਤੀ ਕਰ ਸਕਦੇ ਹਾਂ ਧੰਨਵਾਦ